ਹਾਂਜੀ ਕਿੱਦਾਂ ਜੀ ਮੈਂ ਤੁਹਾਡੀ ਫ੍ਰੈਂਡ ਬੋਲਦੀ ਹਾਂ ਜੀ ਮੈਂ ਤੁਹਾਡੇ ਮੈਂ ਤੁਹਾਡੇ ਸ਼ਹਿਰ ਜਾਣਾ ਹੈ ਇੱਥੇ ਰਹਿਣ ਵਾਸਤੇ ਟ੍ਰੈਫ਼ਿਕ ਕਿੱਦਾਂ ਇੱਥੇ ਪਲਊਸ਼ਨ ਪਲਾਸ਼ਨ ਕਿੰਨਾਂ ਕੁ ਆ ਹਾਂਜੀ

ਅੱਛਾ ਅੱਛਾ ਅੱਛਾ ਬੱਸਾਂ ਕਿੱਦਾਂ ਜੀ ਇੱਥੇ ਬੱਸਾਂ ਬੁੱਸਾਂ ਠੀਕ ਠਾਕ ਚੱਲਦੀਆਂ ਟਾਈਮ 'ਤੇ ਕਿ ਬੇਟਾਈਮੀ ਚੱਲੀ ਜਾਂਦੀਆਂ ਇੱਥੇ ਅੱਛਾ ਜੀ ਅੱਛਾ ਇੱ ਇੱਥੇ ਜਾਣੀ ਵਧੀਆ ਆ ਸਾਰੀਆਂ ਸਹੂਲਤਾਂ ਹੈਗੀਆਂ ਇੱਥੇ ਸਾਰੀਆਂ ਸਹੂਲਤਾਂ ਹੈਗੀਆਂ ਅੱਛਾ ਜੀ ਅੱਛਾ ਠੀਕ ਹੈ ਜੀ ਓਕੇ ਸਭ ਠੀਕ ਆ ਜੀ